ਪੰਜਾਬੀ ਭਾਸ਼ਾ ਸਮੇਂ ਨਾਲ ਕਿਵੇਂ ਬਦਲੀ ਪੰਜਾਬੀ ਭਾਸ਼ਾ ਦਾ ਵਿਕਾਸ ਸਮੇਂ ਨਾਲ ਵੱਖ ਵੱਖ ਕਾਰਨਾਂ ਕਰਕੇ ਪ੍ਰਭਾਵਿਤ ਹੋਇਆ ਜਿਸ ਵਿੱਚ ਇਤਿਹਾਸਿਕ ਸੱਭਿਆਚਾਰਿਕ ਅਤੇ ਹੋਰ ਭਾਸ਼ਾਵਾਂ ਸ਼ਾਮਿਲ ਹੋਣਾ ਹੈ ਸਭ ਤੋਂ ਪਹਿਲਾਂ ਇਤਿਹਾਸਿਕ ਪੰਜਾਬ ਦਾ ਇਤਿਹਾਸ ਅਲੱਗ ਅਲੱਗ ਭਾਸ਼ਾਵਾਂ ਅਤੇ ਸਮਰਾਜਾਂ ਵਾਲਾ ਹੈ ਜਿਵੇਂ ਸਿੰਧੂ ਘਾਟੀ ਸੱਭਿਅਤਾ ਮੁਗਲ ਸਮਰਾਜ ਸਿੱਖ ਸਮਰਾਜ ਇਹਨਾਂ ਦੇ ਕਰਕੇ ਪੰਜਾਬ ਦਾ ਇਤਿਹਾਸ ਅਮੀਰ ਹੈ ਇਹਨਾਂ ਸਭ ਨੇ ਪੰਜਾਬੀ ਭਾਸ਼ਾ ਵਿੱਚ ਕੁਝ ਨਾ ਕੁਝ ਸ਼ਾਮਿਲ ਜਾਂ ਯੋਗਦਾਨ ਕੀਤਾ ਆਪਣਾ ਯੋਗਦਾਨ ਪਾਇਆ ਦੂਜਾ ਅੰਗਰੇਜ਼ਾਂ ਦਾ ਪੰਜਾਬ 'ਤੇ ਕਬਜ਼ਾ ਅੰਗਰੇਜ਼ਾਂ ਦੇ ਆਉਣ ਨਾਲ ਪੰਜਾਬੀ ਭਾਸ਼ਾ ਵਿੱਚ ਬਹੁਤ ਬਦਲਾਅ ਹੋਏ ਖਾਸ ਕਰਕੇ ਸ਼ਹਿਰੀ ਖੇਤਰ ਅਤੇ ਪੜ੍ਹੇ ਲਿਖੇ ਵਰਗ ਵਿੱਚ ਕਿਉਂਕਿ ਇਹਨਾਂ ਨੇ ਆਪਣੀ ਭਾਸ਼ਾ ਦੇ ਕੁਛ ਸ਼ਬਦ ਪੰਜਾਬੀ ਭਾਸ਼ਾ ਨਾਲ ਬੋਲਣੇ ਸ਼ੁਰੂ ਕਰ ਦਿੱਤੇ ਫਿਰ ਉੱਨੀ ਸੌ ਸੰਤਾਲੀ ਦੀ ਵੰਡ ਭਾਰਤ ਦੀ ਵੰਡ ਕਰਕੇ ਪਾਕਿਸਤਾਨ ਬਣਾਇਆ ਇਸ ਵਿੱਚ ਪੰਜਾਬ ਦੇ ਦੋ ਹਿੱਸੇ ਹੋ ਗਏ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਗਿਆ ਅੱਧਾ ਪਾਕਿਸਤਾਨ ਚਲਾ ਗਿਆ ਅੱਧਾ ਭਾਰਤ 'ਚ ਰਹਿ ਗਿਆ ਇਸ ਦਾ ਵੀ ਪੰਜਾਬੀ ਭਾਸ਼ਾ 'ਤੇ ਬਹੁਤ ਗਹਿਰਾ ਅਸਰ ਹੋਇਆ ਅੱਜ ਦੀ ਗੱਲ ਕਰੀਏ ਤਾਂ ਜਿਵੇਂ ਗਲੋਬਲਾਈਜੇਸ਼ਨ ਇਸ ਨਾਲ ਵੱਖ ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਮਿਲਣ ਦੀ ਖੁੱਲ੍ਹ ਮਿਲ ਗਈ ਜਿਸ ਕਰਕੇ ਉਹ ਇੱਕ ਦੂਜੇ ਨਾਲ ਸ਼ਾਮਿਲ ਹੋ ਗਏ ਹੋਰ ਦੇਖਿਆ ਜਾਏ ਤਾਂ ਜਿਵੇਂ ਮੀਡੀਆ ਜਾਂ ਟੈਕਨੋਲੋਜੀ ਟੀ ਵੀ ਰੇਡੀਓ ਅਤੇ ਇੰਟਰਨੈਟ ਕਰਕੇ ਹੋਰ ਨਵੇਂ ਸ਼ਬਦ ਪੰਜਾਬੀ ਭਾਸ਼ਾ ਵਿੱਚ ਆਮ ਬੋਲੇ ਜਾਣ ਲੱਗ ਪਏ ਜੋ ਅੱਗੇ ਨਹੀਂ ਬੋਲੇ ਜਾ ਸਕਦੇ ਜਾਂਦੇ ਸੀ ਇਸਦੇ ਬਾਵਜੂਦ ਵੀ ਪੰਜਾਬੀ ਇੱਕ ਵਿਲੱਖਣ ਪਛਾਣ ਰੱਖਦੀ ਹੈ ਇੱਕ ਆਪਣਾ ਅਲੱਗ ਦਰਜਾ ਰੱਖਦੀ ਹੈ ਬਾਕੀ ਮੇਰੇ ਖਿਆਲ ਨਾਲ ਪਨ ਭਾਸ਼ਾ ਦਾ ਬਦਲਾਅ ਬਦਲਣਾ ਸੋਰੀ ਭਾਸ਼ਾ ਦਾ ਬਦਲਣਾ ਜਾਂ ਵਿਕਾਸ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਸਮਾਜ ਅਤੇ ਸਮੇਂ ਨਾਲ ਹੁੰਦੀ ਰਹਿੰਦੀ ਹੈ